ਹਾਂਜੀ ਜੀ ਮੈਂ ਤੁਸੀਂ ਪੁੱਛਿਆ ਹੈਗਾ ਵੀ ਤੁਸੀਂ ਕੀ ਕਰਦੇ ਹੋ ਹੈ ਨਾ ਸਰ ਆਪਣਾ ਮੁਕਾਮ ਹਾਸਲ ਕਰਨ ਕਿ ਵਾਪਸ ਆਉਣ ਦੀ ਸੱਤ ਸੈਕਿੰਡ ਪਹਿਲਾਂ ਜਿਹੜਾ ਕਿ ਧਰਤੀ 'ਤੇ ਪਹੁੰਚਣ ਤੋਂ ਉਹਨਾਂ ਦੀ ਮੌਤ ਹੋ ਗਈ ਉਹਨਾਂ ਨੂੰ ਵੇਖ ਕੇ ਹੋਰ ਵੀ ਕਈ ਲੇਡੀਜ ਇੱਦਾਂ ਦੀਆਂ ਨੇ ਜਿਹੜਾ ਕਿ ਆਪਣਾ ਜਿਹੜਾ ਮੁਕਾਮ ਹੈ ਉਹ ਹਾਸਿਲ ਕਰਨਾ ਚਾਹੁੰਦੀ ਆ ਨੇ ਅਤੇ ਹਾਸਲ ਕਰ ਵੀ ਰਹੀਆਂ ਨੇ ਬਹੁਤ ਜ਼ਿਆਦਾ ਸਿੱਖਿਆ ਮਿਲੀ ਹੈ ਕਲਪਨਾ ਚਾਵਲਾ ਤੋਂ ਜੋ ਕਿ ਉਹ ਪਹਿਲੀ ਕੁੜੀ ਸੀ ਚੰਦਰਮਾ 'ਤੇ ਪਹੁੰਚੀ ਸੀ ਔਰ ਹਾਂ ਸਲਿਊ ਨੇ ਆਪਣਾ ਮੁਕਾਮ ਕੀਤਾ ਉਸ ਤੋਂ ਬਾਅਦ ਕਈ ਜ਼ਿਆਦਾ ਕੁੜੀਆਂ ਇੱਦਾਂ ਦੀਆਂ ਨੇ ਹੈਗੀਆਂ ਨੇ ਜਿਹੜੀਆਂ ਕਿ ਆਪਣਾ ਮੁਕਾਮ ਹਾਸਿਲ ਕਰਨਾ ਚਾਹੁੰਦੀ ਨੇ ਜਾਣਾ ਚਾਹੁੰਦੀਆਂ ਨੇ ਔਰ ਕਰ ਵੀ ਚੁੱਕੀਆਂ ਨੇ ਤਾਂ ਉਹਨਾਂ ਨੇ ਇੱਕ ਆਪਣੀ ਛਾਪ ਛੱਡੀ ਹੈ ਇਹ ਮੁਕਾਮ ਹਾਸਿਲ ਕਰਕੇ ਕਿ ਅੱਗੇ ਤੋਂ ਹੋਰ ਵੀ ਦਲੇਰ ਹੋਈਆਂ ਨੇ ਜਿਹੜੇ ਲੇਡੀਜ ਨੇ ਜਿਹੜੀਆਂ ਕਿ ਅੱਗੇ ਜਾਣ ਬਾਰੇ ਸੋਚ ਨਹੀਂ ਸਿਖਾਈ ਦੀਆਂ ਅੱਜ ਕੱਲ੍ਹ ਉਹ ਬਹੁਤ ਜ਼ਿਆਦਾ ਨੇ ਜਿਹੜੀਆਂ ਕਿ ਆਪਣਾ ਮੁਕਾਮ ਹਾਸਿਲ ਕਰਕੇ ਆਪਣਾ ਨਾਮ ਜਿਹੜਾ ਕਿ ਜੱਗ 'ਤੇ ਛਾਪਣਾ ਚਾਹੁੰਦੀ ਹਾਂ